ਸਾਡੇ ਸ਼ਹਿਰ ਵਿੱਚ ਧਾਰਮਿਕ ਸਥਾਨਾਂ 'ਤੇ ਕਾਫ਼ੀ ਤਰ੍ਹਾਂ ਦੇ ਧਾਰਮਿਕ ਸੱਭਿਆਚਾਰਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਜਿਵੇਂ ਕਿ ਤਿਉਹਾਰਾਂ ਦੇ ਉੱਤੇ ਇੱਥੇ ਗੁਰਦੁਆਰਿਆਂ ਵਿੱਚ ਗੁਰਪੁਰਬ ਮਨਾਇਆ ਜਾਂਦਾ ਹੈ ਕਿਸੇ ਵੀ ਗੁਰੂ ਨਾਲ਼ ਸਬੰਧਿਤ ਉਹਨਾਂ ਦਾ ਜਨਮ ਦਿਨ ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਅਤੇ ਭਾਰੀ ਮਾਤਰਾ ਵਿੱਚ ਸੰਗਤ ਇਕੱਠੀ ਹੋ ਕੇ ਪਾਠ ਕਰਦੇ ਹਨ ਸੇਵਾ ਕਰਦੇ ਹਨ ਅਤੇ ਲੰਗਰ ਲਗਾਏ ਜਾਂਦੇ ਹਨ ਇਸ ਤੋਂ ਇਲਾਵਾ ਮੰਦਰਾਂ ਦੇ ਵਿੱਚ ਜਨਮ ਆਸ਼ਟਮੀ ਸ਼ਿਵਰਾਤਰੀ ਦੇ ਮੌਕਿਆ 'ਤੇ ਆਰਤੀ ਹੁੰਦੀ ਹੈ ਲੰਗਰ ਲਗਾਏ ਜਾਂਦੇ ਹਨ ਅਤੇ ਪੂਜਾ ਅਰਾਧਨਾ ਕੀਤੀ ਜਾਂਦੀ ਹੈ ਐਤਵਾਰ ਵਾਲੇ ਦਿਨ ਕ੍ਰਿਸ਼ਚਨ ਲੋਕ ਈਸਾਈ ਧਰਮ ਦੇ ਲੋਕ ਆਪਣੀ ਪ੍ਰਾਰਥਨਾ ਕਰਦੇ ਹਨ ਅਤੇ ਇਸ ਤੋਂ ਇਲਾਵਾ ਦਰਗਾਹ ਦੇ ਉੱਤੇ ਵੀਰਵਾਰ ਵਾਲੇ ਦਿਨ ਪੀਰ ਦੀ ਪੀਰ ਦੀ ਦਰਗਾਹ ਦੇ ਉੱਤੇ ਮੱਥੇ ਟੇਕੇ ਜਾਂਦੇ ਹਨ ਅਤੇ ਲੋਕ ਉੱਥੇ ਜਾ ਕੇ ਆਪਣੇ ਅਰਦਾਸ ਕਰਦੇ ਹਨ ਉੱਥੇ ਸੇਵਾ ਕਰਦੇ ਹਨ ਇਸ ਪ੍ਰਕਾਰ ਉਹ ਉੱਥੇ ਬੈਠ ਕੇ ਆਪਣਾ ਧਾਰਮਿਕ ਸਮਾਗਮ ਦਾ ਅਨੰਦ ਮਾਣਦੇ ਹਨ ਗੁਰਦੁਆਰਿਆਂ ਵਿੱਚ ਪਾਠ ਕੀਤੇ ਜਾਂਦੇ ਹਨ ਅਲੱਗ ਅਲੱਗ ਜਗ੍ਹਾ ਤੋਂ ਢਾਡੀ ਜੱਥੇ ਆਉਂਦੇ ਹਨ ਅਤੇ ਉਹ ਆ ਕੇ ਉੱਥੇ ਕੀਰਤਨ ਕਰਦੇ ਹਨ